ਜੇਕਰ ਕਿਸੇ ਨੇ ਸਿੱਖਿਆ ਜਾਂ ਪੜ੍ਹਾਈ ਹਾਸਲ ਕਰਨੀ ਹੈ ਪਰੰਤੂ ਉਸ ਕੋਲ ਓਨੇ ਪੈਸੇ ਨਹੀਂ ਹੁੰਦੇ ਹਨ ਜਿਸ ਨਾਲ ਉਹ ਆਪਣੀ ਪੜ੍ਹਾਈ ਨੂੰ ਅੱਗੇ ਵਧਾ ਸਕੇ ਜਾਂ ਪੂਰਾ ਕਰ ਸਕੇ ਜਾਂ ਆਪਣੇ ਮਨਪਸੰਦ ਦਾ ਕੋਰਸ ਲੈ ਸਕੇ ਜਿਸ ਲਈ ਉਹਨਾਂ ਕੋਲ ਇੱਕ ਵਿਕਲਪ ਵੀ ਹੈ ਜੋ ਕਿ ਸਿੱਖਿਆ ਕਰਜ਼ਾ ਦੇ ਨਾਮ ਤੋਂ ਹੈ ਉਹ ਇਸ ਸਿੱਖਿਆ ਕਰਜ਼ਾ ਦਾ ਫਾਇਦਾ ਲੈ ਕੇ ਆਪਣੀ ਪੜ੍ਹਾਈ ਨੂੰ ਆਪਣੇ ਮਨਪਸੰਦ ਦੇ ਕੋਲੇਜ ਵਿੱਚ ਦਾਖਲਾ ਲੈ ਕੇ ਪੂਰਾ ਕਰ ਸਕਦੇ ਹਨ ਜਿਵੇਂ ਕਿ ਇਸ ਸਿੱਖਿਆ ਕੋਰਸ ਦਾ ਇੱਕ ਦੂਸਰਾ ਨਾਮ ਵੀ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਅਸੀਂ ਲੋਨ ਕਹਿ ਦਿੰਦੇ ਹਨ ਅੱਜ ਕੱਲ੍ਹ ਲੋਕ ਸਿੱਖਿਆ ਕਰਜ਼ਾ ਜਾਂ ਲੋਨ ਲੈ ਕੇ ਆਪਣੇ ਪੜ੍ਹਾਈਆਂ ਨੂੰ ਆਸਾਨੀ ਤਰੀਕੇ ਨਾਲ ਪੂਰਾ ਕਰ ਲੈਂਦੇ ਹਨ ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਸਰਕਾਰ ਦੁਆਰਾ ਆਸਾਨੀ ਨਾਲ ਕਰਜ਼ਾ ਮਿਲ ਜਾਂਦਾ ਹੈ ਜੋ ਕਿ ਜ਼ੀਰੋ ਪਰਸੈਂਟ ਵਿਆਜ 'ਤੇ ਵੀ ਕਈ ਵਾਰ ਮਿਲਦਾ ਹੈ ਜੋ ਬੱਚਿਆਂ ਲਈ ਬਹੁਤ ਆਸਾਨ ਹੁੰਦਾ ਹੈ ਅੱਗੇ ਜਾ ਕੇ ਇਸ ਕਰਜ਼ੇ ਨੂੰ ਚੁਕਾਉਣਾ ਕਿਉਂਕਿ ਸਿੱਖਿਆ ਕਰਜ਼ਾ ਜੋ ਹੁੰਦਾ ਹੈ ਜਦੋਂ ਤੱਕ ਬੱਚਿਆਂ ਦੀ ਪੜ੍ਹਾਈ ਪੂਰੀ ਹੋ ਕੇ ਉਹਨਾਂ ਨੂੰ ਜੌਬ ਨਹੀਂ ਮਿਲ ਜਾਂਦੀ ਤਦ ਤੱਕ ਸਰਕਾਰ ਦੁਆਰਾ ਇੱਕ ਨਿਯਮ ਹੈ ਕਿ ਇਹ ਕੋਈ ਬੈਂਕ ਕਰਮਚਾਰੀ ਕੋਈ ਵੀ ਉਹਨਾਂ ਨੂੰ ਪਰੈਸ਼ਰ ਨਹੀਂ ਪਾ ਸਕਦਾ ਕਿ ਉਹ ਸਾਨੂੰ ਸਮੇਂ ਤੋਂ ਪਹਿਲੇ ਹੀ ਜੋ ਕਰਜ਼ੇ ਹੈ ਉਹ ਚੁਕਾਉਣ ਵਿੱਚ ਮਦਦ ਕਰਨ ਇਸ ਲਈ ਲੋਕ ਇਹਨਾਂ ਸਿੱਖਿਆ ਕਰਜ਼ਿਆਂ ਨੂੰ ਦਾ ਫਾਇਦਾ ਚੱਕਦੇ ਹਨ ਅਤੇ ਇਸ ਲਈ ਉਹ ਇਸ ਦੇ ਨਾਲ ਹੀ ਆਪਣੇ ਮਨਪਸੰਦ ਦੀ ਪੜ੍ਹਾਈ ਦੂਰ ਦਰਾਜ਼ ਦੇ ਕੋਲਜਾਂ ਯੂਨੀਵਰਸਿਟੀਆਂ ਜਾਂ ਦੇਸ਼ਾਂ ਵਿੱਚ ਜਾ ਕੇ ਪੂਰੀ ਕਰਦੇ ਹਨ ਇ ਜਿਵੇਂ ਕਿ ਮੈਂ ਗੱਲ ਕਰਾਂ ਇੱਕ ਹੀ ਮੇਰੇ ਜਾਣਕਾਰ ਸੀ ਜੋ ਕਿ ਕੁਛ ਸਮੇਂ ਪਹਿਲੇ ਹੀ ਜਿਹਨਾਂ ਨੇ ਬਾਹਰ ਜਾਣਾ ਸੀ ਬਟ ਉਹਨਾਂ ਨੂੰ ਪੈਸਿਆਂ ਦੀ ਵੀ ਦਿੱਕਤ ਸੀ ਉਹਨਾਂ ਦੇ ਘਰ ਦੇ ਉੱਨਾ ਪੈਸਾ ਨਹੀਂ ਲਗਾ ਸਕਦੇ ਸਨ ਜਿਸ ਨਾਲ ਉਹ ਬਾਹਰ ਜਾ ਕੇ ਆਪਣਾ ਮਨਪਸੰਦ ਕੋਰਸ ਲੈ ਕੇ ਉਸ ਨੂੰ ਉਸ ਦੀ ਪੜ੍ਹਾਈ ਕਰ ਸਕਣ ਤਾਂ ਉਹਨਾਂ ਨੇ ਆਪਣੇ ਲਈ ਸਿੱਖਿਆ ਕਰਜ਼ਾ ਬੈਂਕ ਵਿੱਚੋਂ ਅਪਲਾਈ ਕੀਤਾ ਅਤੇ ਕੁਛ ਹੀ ਦਿਨਾਂ ਵਿੱਚ ਉਹਨਾਂ ਨੂੰ ਕਰਜ਼ਾ ਮਿਲ ਗਿਆ ਇਸ ਲਈ ਉਹ ਆਸਾਨੀ ਨਾਲ ਹੁਣ ਆਪਣੀ ਪੜ੍ਹਾਈ ਵਿੱਚ ਧਿਆਨ ਦੇ ਰਹੇ ਹਨ ਅਤੇ ਜਲਦੀ ਹੀ ਉਹ ਆਪਣੀ ਪੜ੍ਹਾਈ ਪੂਰੀ ਕਰ ਲੈਣਗੇ